ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਸਰੀਰਿਕ ਜਾਂ ਮਾਨਸਿਕ ਮਾਨਸਿਕ ਬੰਦਾ ਬਹੁਤ ਅੱਛੀ ਤਰ੍ਹਾਂ ਨਾਲ ਮਹਿਸੂਸ ਕਰਦਾ ਹੈ ਕਿਉਂਕਿ ਭੰਗੜਾ ਐਰੋਬਿਕਸ ਵਿੱਚ ਹਿੱਸਾ ਲੈਣ ਨਾਲ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਅਤੇ ਸਾਡੇ ਵਰਗੇ ਵੀ ਜਦੋਂ ਹਿੱਸਾ ਲੈਂਦੇ ਹਨ ਅਤੇ ਆਪਣੇ ਆਪ ਨੂੰ ਤਰੋ ਤਾਜ਼ਾ ਮਹਿਸੂਸ ਕਰਦੇ ਹਨ ਇਸ ਕਰਕੇ ਭੰਗੜਾ ਐਰੋਬਿਕਸ ਵਿੱਚ ਅੱਜ ਕੱਲ੍ਹ ਤੁਸੀਂ ਦੇਖੋਗੇ ਜਗ੍ਹਾ ਜਗ੍ਹਾ 'ਤੇ ਭੰਗੜਾ ਐਰੋਬਿਕਸ ਖੋ ਉਹ ਸਿਖਾਉਣ ਵਾਲੇ ਕੇਂਦਰ ਖੁੱਲ੍ਹੇ ਹੋਏ ਨੇ ਅਤੇ ਬੱਚੇ ਕੋਈ ਦੇਖੋ ਤੁਸੀਂ ਗਰਮੀ ਦੇ ਮੌਸਮ 'ਚ ਜਾਂ ਸਰਦੀ ਦੇ ਮੌਸਮ 'ਚ ਦੁਪਹਿਰ ਨੂੰ ਗਰਮੀ ਦੇ ਮੌਸਮ 'ਚ ਸ਼ਾਮ ਨੂੰ ਦੇਖੋ ਤੁਸੀਂ ਪਾਰਕਾਂ ਵਿੱਚ ਬੱਚੇ ਸਿੱਖਦੇ ਹਨ ਉਹਨਾਂ ਨੂੰ ਬਹੁਤ ਖੁੱਲ੍ਹੀ ਤਾਜ਼ੀ ਹਵਾ 'ਚ ਸਿੱਖਦੇ ਹਨ ਕੋਈ ਬੰਦ ਕੋਈ ਕਲੱਬਾਂ ਵੈਗਰਾ ਵਿੱਚ ਸਿੱਖਦੇ ਹਨ ਅਤੇ ਬੱਚਿਆਂ ਨੂੰ ਬੜਾ ਉਹਨਾਂ ਨਾਲ ਸਰੀਰਿਕ ਵਿਕਾਸ ਹੁੰਦਾ ਹੈ ਉਹਨਾਂ ਦਾ ਅਤੇ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਹੈ ਅਤੇ ਇਸ ਤਰ੍ਹਾਂ ਮਾਂ ਬਾਪ ਨੂੰ ਵੀ ਖੁਸ਼ ਹੁੰਦੇ ਹਨ ਅਤੇ ਬੱਚਿਆਂ ਦੀ ਇੱਕ ਤਰ੍ਹਾਂ ਦੀ ਖੇਡ ਵੀ ਹੋ ਜਾਂਦੀ ਹੈ ਨਾਲੇ ਸਰੀਰਿਕ ਵਿਕਾਸ ਵੀ ਚੰਗੀ ਤਰ੍ਹਾਂ ਹੋਣ ਲੱਗ ਜਾਂਦਾ ਅਤੇ ਬੱਚੇ ਆਪਣੇ ਆਪ ਨੂੰ ਤੰਦਰੁਸਤ ਸਮਝਦੇ ਹਨ ਬੱਚਿਆਂ ਦੇ ਨਾਲ ਸਾਰੀ ਐਕਸਰਸਾਈਜ਼ ਵੀ ਹੋ ਜਾਂਦੀ ਹੈ ਉਹਨਾਂ ਦੀ ਸਾਰੀ ਹਰ ਤਰ੍ਹਾਂ ਨਾਲ ਉਹ ਦਿਮਾਗ ਵੀ ਫਰੈਸ਼ ਰੇ ਰਹਿੰਦਾ ਹੈ ਅਤੇ ਮਾਂ ਬਾਪ ਨੂੰ ਉਹਨਾਂ ਨੂੰ ਮਾਂ ਬਾਪ ਨੂੰ ਵੀ ਖੁਸ਼ੀ ਹੁੰਦੀ ਹੈ ਅਤੇ ਨਾਲੇ ਬੱਚਿਆਂ ਨੂੰ ਕੋਈ ਨਾ ਕੋਈ ਚੀਜ਼ ਸਿੱਖਣ ਨੂੰ ਮਿਲਦੀ ਹੈ ਅਤੇ ਇਸ ਤਰ੍ਹਾਂ ਬੱਚੇ ਇਹਨੂੰ ਸਿੱਖ ਕੇ ਸਕੂਲ ਦੇ ਕਿਸੇ ਵੀ ਕੋਈ ਫੰਕਸ਼ਨ ਹੋਏ ਸਕੂਲ ਦਾ ਕੋਈ ਹੋਏ ਅਤੇ ਉਹਦੇ ਵਿੱਚ ਹਿੱਸਾ ਲੈਂਦੇ ਹਨ ਅਤੇ ਉਹਨਾਂ ਨੂੰ ਉਹਦੇ ਵਿੱਚ ਜਦੋਂ ਬੱਚੇ ਅੱਗੇ ਹੋ ਕੇ ਇਨਾਮ ਲੈ ਕੇ ਆਉਂਦੇ ਹਨ ਅਤੇ ਮਾਂ ਬਾਪ ਨੂੰ ਹੋਰ ਖੁਸ਼ੀ ਹੁੰਦੀ ਹੈ ਇਸ ਕਰਕੇ ਅੱਜ ਕੱਲ੍ਹ ਦੇ ਵਿੱਚ ਤੁਸੀਂ ਮਾਂ ਸਰੀਰਿਕ ਤੌਰ 'ਤੇ ਅਤੇ ਮਾਨਸਿਕ ਤੌਰ 'ਤੇ ਅਤੇ ਉਹ ਚੰਗੇ ਰਹਿੰਦੇ ਹੀ ਹਨ ਅਤੇ ਇਸ ਕਰਕੇ ਸਾਨੂੰ ਵੀ ਇਸ ਵਿੱਚ ਹਿੱਸਾ ਲੈ ਕੇ ਬਹੁਤ ਵਧੀਆ ਲੱਗਦਾ ਹੈ ਅਤੇ ਅਸੀਂ ਵੀ ਸਾਰਿਆਂ ਨੂੰ ਇਹੀ ਕਹਾਂਗੇ ਕਿ ਅੱਜ ਕੱਲ੍ਹ ਜਿੱਦਾਂ ਸਰੀਰ ਜਿੱਦਾਂ ਦਾ ਖਾਣ ਪਾਣ ਹੈ ਉਹਦੇ ਦੇ ਤੌਰ 'ਤੇ ਸਭ ਨੂੰ ਭੰਗੜਾ ਐਰੋਬਿਕਸ ਸਿੱਖਣਾ ਚਾਹੀਦਾ ਹੈ ਭਾਵੇਂ ਥੋੜ੍ਹੀ ਦੇਰ ਲਈ ਸਿੱਖੋ ਜਿੰਨਾ ਤੁਸੀਂ ਆਪਣੇ ਸਰੀਰ ਨੂੰ ਤਰੋ ਤਾਜ਼ਾ ਅਤੇ ਦਿਮਾਗ ਨੂੰ ਵੀ ਤਰੋ ਤਾਜ਼ਾ ਰੱਖ ਸਕੋ